ਹੈਲੋ ਹੈਲੋ ਹਾਂਜੀ ਨਮਸਕਾਰ ਜੀ ਇੱਕ ਨਾ ਹਾਂਜੀ ਮੈਂ ਨਾ ਜੀ ਜੀ ਮੀਡੀਆ ਤੋਂ ਰਾਹੁਲ ਗੱਲ ਕਰ ਰਿਹਾ ਸੀਗਾ ਜੀ ਮੀਡੀਆ ਆਪਣਾ ਮੀਡੀਆ ਚੈਨਲ ਹੈ ਜੀ ਇੱਕ ਅਤੇ ਇਲੈਕਟਰੋਨਿਕ 'ਚ ਵੀ ਹੈ ਅਤੇ ਡਿਜਿਟਲ 'ਚ ਵੀ ਹੈ ਮਤਲਬ ਆਹ ਜਿਹੜਾ ਪ੍ਰੈੱਸ 'ਚ ਹੁੰਦੀ ਹੈ ਅਤੇ ਨਾ ਮੈਂ ਇੱਕ ਨਾ ਤੁਸੀਂ ਫਾਜ਼ਿਲਕਾ ਤੋਂ ਬੋਲ ਰਹੇ ਹੋ ਨਾ ਫਾਜ਼ਿਲਕਾ ਪੰਜਾਬ ਤੋਂ ਹਾਂਜੀ ਹਾਂਜੀ ਤੁਸੀਂ ਵੈਸੇ ਕੀ ਕਰਦੇ ਹੋ ਅੱਜ ਕੱਲ੍ਹ ਥੋੜ੍ਹਾ ਪੁੱਛ ਸਕਦਾਂ ਅ ਐਕਚੁਲੀ ਨਾ ਜੀ ਮੈਨੂੰ ਥੋੜ੍ਹਾ ਇੰਟਰਸਟ ਆ ਜੀ ਤੁਹਾਡੇ ਸ਼ਹਿਰ ਬਾਰੇ ਮੈਨੂੰ ਨਾ ਐਕਚੁਲੀ ਪਤਾ ਲੱਗਿਆ ਕਿ ਨਾ ਤੁਹਾਡੇ ਸ਼ਹਿਰ 'ਚ ਨਾ ਥੋੜ੍ਹਾ ਥੋੜ੍ਹਾ ਨਾ ਜਿਵੇਂ ਸੁਪਰਸਟੀਟਸ ਗੱਲਾਂ ਹੁੰਦੀਆਂ ਜਿਵੇਂ ਅੰਧ ਵਿਸ਼ਵਾਸ ਟਾਈਪ ਦੀਆਂ ਮਤਲਬ ਵੀ ਜ਼ਿਆਦਾ ਉੱਥੇ ਲੋਕ ਫੋਲੋ ਕਰਦੇ ਹੈਗੇ ਅਤੇ ਅਸੀਂ ਨਾ ਇੱਕ ਨਾ ਉਹ ਬਣਾ ਰਹੇ ਹਾਂ ਅਸੀਂ ਨਾ ਆਰਟੀਕਲ ਇੱਕ ਇੱਕ ਇੱਕ ਇੱਕ ਤਾਂ ਅਸੀਂ ਆਰਟੀਕਲ ਵੀ ਛਾਪਣਾ ਠੀਕ ਹੈ ਜੀ ਇੱਕ ਥੋੜ੍ਹੀ ਨਾ ਅਸੀਂ ਸ਼ੋਟ ਵੀਡੀਓ ਟਾਈਪ ਨਹੀਂ ਡਾਕੂਮੈਨਟਰੀ ਨਹੀਂ ਹੁੰਦੀ ਜਿਵੇਂ ਇੱਕ ਅਸੀਂ ਉਹ ਵੀ ਬਣਾਉਣੀ ਆ ਜੀ ਸਾਡਾ ਸ਼ੋਅ ਸਟਾਰਟ ਹੋ ਜਾਵੇ ਜੀ ਮੀਡੀਆ 'ਤੇ ਅਤੇ ਅਸੀਂ ਨਾ ਉੱਧਰ ਵੇਖਣਾ ਕਿ ਅਸੀਂ ਤੁਹਾਨੂੰ ਨਾ ਤ ਤੁ ਤੁਹਾਡੇ ਘਰ ਨਾ ਲੋਕਾਂ ਨੇ ਬਹੁਤ ਸਾਨੂੰ ਦੱਸਿਆ ਕਿ ਫਾਜ਼ਿਲਕਾ ਜਾ ਕੇ ਤੁਸੀਂ ਪਤਾ ਕਰੋ ਫਾਜ਼ਿਲਕਾ ਜਾ ਕੇ ਪਤਾ ਕਰੋ ਅਸੀਂ ਕਿਹਾ ਚਲੋ ਜੀ ਅਸੀਂ ਕਰਦੇ ਹਾਂ ਟਰਾਈ ਸਾਨੂੰ ਤੁਹਾਡਾ ਨੰਬਰ ਮਿਲਿਆ ਕਿੱਧਰੋਂ ਅਤੇ ਤੁਸੀਂ ਥੋੜ੍ਹਾ ਦੱਸੋਗੇ ਕਿ ਮਤਲਬ ਕਿ ਕਿਸ ਕਿਸ ਹਿਸਾਬ ਨਾਲ ਫਾਜ਼ਿਲਕਾ 'ਚ ਇਹ ਗੱਲਾਂ ਚੱਲਦੀਆਂ ਜੀ ਥੋੜ੍ਹਾ ਬਹੁਤਾ ਦੱਸ ਸਕੋ ਤਾਂ ਮਾੜਾ ਮੋਟਾ ਹੇਲਪ ਹੋ ਜੇ ਸਾਡੀ ਆਪ ਵੀ ਕਰੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ

ਅੱਛਾ ਜੀ ਅੱਛਾ ਜੀ ਅੱਛਾ ਅੱਛਾ ਹਾਂਜੀ ਪੰਕਜ ਇਹ ਤਾਂ ਵੈਸੇ ਨਾ ਇਹ ਇਹ ਤਾਂ ਪੰਕਜ ਵੈਸੇ ਸਾਡੇ ਵਾਲੀ ਸ਼ਾਇਡ ਵੀ ਕਹਿੰਦੇ ਹੁੰਦੇ ਨੇ ਮੈਂ ਇੱਧਰੋਂ ਪਠਾਨਕੋਟ ਸਾਈਡ ਤੋਂ ਹਾਂ ਮੈਂ ਅਤੇ ਇੱਦਾਂ ਵੈਸੇ ਮੇਰੀ ਮੰਮੀ ਵੀ ਕਹਿੰਦੀ ਹੁੰਦੀ ਕਿ ਮਿੱਠਾ ਖਾ ਕੇ ਨਾ ਜਾਓ ਪਰ ਇੰਨਾ ਕੁਝ ਨਹੀਂ ਹੈਗੀ ਤਿੰਨ ਬੰਦੇ ਨੇ ਜਾਣਾ ਦੋ ਬੰਦੇ ਨੇ ਜਾਣਾ ਇਹ ਤਾਂ ਮੈਨੂੰ ਤੁਹਾਡੇ ਤੋਂ ਪਤਾ ਲੱਗਿਆ ਪਹਿਲੀ ਵਾਰੀ

ਹਾਂਜੀ ਹਾਂਜੀ ਅੱਛਾ ਜੀ ਹੁਣ ਤਾਂ ਜੀ ਮਾਹੌਲ ਹੈ ਹੀ ਨਹੀਂ ਜੀ ਆਇਆ ਜੀ ਹੁਣ ਤਾਂ ਕੋਈ ਮਾਹੌਲ ਨਹੀਂ ਹੈਗਾ ਜੀ

ਕਿਉਂਕਿ ਵੇਖੋ ਜੀ ਮੈਂ ਪਠਾਨਕੋਟ ਸਾਈਡ ਤੋਂ ਹਾਂ ਸਾਡੇ ਵੀ ਬੋਰਡਰ ਲੱਗਦਾ ਸਾਨੂੰ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਜੰਮੂ ਕਸ਼ਮੀਰ ਨਾਲ ਲੱਗਦਾ ਸਾਡੇ ਅੱਛਾ ਜੀ ਅੱਛਾ ਜੀ

ਮਤਲਬ ਸ਼ਾਇਦ ਨਾ ਫਿਰ ਮੈਂ ਥੋੜ੍ਹਾ ਥੋੜ੍ਹਾ ਨਾ ਬੈਕਵਰਡ ਏਰੀਆ ਟਾਈਪ ਸ਼ਾਇਦ ਕਰਕੇ ਆ ਮੈਨੂੰ ਲੱਗਦਾ ਨਾ ਬੈਕਵਰਡ ਏਰੀਆ ਹੋਏਗਾ ਤਾਂ ਹੀ ਸ਼ਾਇਦ ਕਰਦੇ ਹੈਗੇ ਆ ਵੀ ਜੀ ਤੁਸੀਂ ਮਤਲਬ ਨਾ ਮਤਲਬ ਹਾਂਜੀ ਤੁਸੀਂ ਮੈਨੂੰ ਬਹੁਤ ਜੀ ਮਤਲਬ ਬੜੀ ਵਧੀਆ ਇਨਫੋਰਮੇਸ਼ਨ ਦਿੱਤੀ ਆ ਜੀ ਇਹ ਨਾ ਹੁਣ ਅਸੀਂ ਨਾ ਅਸੀਂ ਸ਼ਾਇਦ ਹੋ ਸਕਦਾ ਦੋ ਚਾਰ ਦਿਨਾਂ 'ਚ ਫਾਜ਼ਿਲਕਾ ਵਿਜਿਟ ਕਰਾਂਗੇ ਅਤੇ ਤੁਹਾਡੇ ਮੇਰੇ ਕੋਲ ਤੁਹਾਡਾ ਨੰਬਰ ਹੈਗਾ ਹੀ ਹੈ ਹਾਂਜੀ ਜੇਕਰ ਤੁਸੀਂ ਫਰੀ ਹੋ ਗਏ ਹੋ ਤੁਸੀਂ ਮਿਲ ਮਿਲ ਸਕਦੇ ਹੋ ਜੀ ਹਾਂਜੀ ਹਾਂਜੀ ਨਹੀਂ ਐਵੇਂ ਨਹੀਂ ਜੀ ਬਿਲਕੁਲ ਹੈ ਪਰਫੂਫ ਨਾਲ ਛਾਪਾਂਗੇ ਜੀ ਐਵੇਂ ਨਹੀਂ ਕਿ ਇੱਧਰੋਂ ਸੁਣ ਲਈ ਉੱਧਰੋਂ ਸੁਣ ਲਈ ਪਰੂਫ ਨਾਲ ਪੂਰੀਆਂ ਤਾਂ ਛਪਾਂਗੇ ਜੀ ਐਂ ਨਹੀਂ ਬਦਨਾਮ ਨਹੀਂ ਕਰਨਾ ਆਪਾਂ ਕਿਸੇ ਸ਼ਹਿਰ ਨੂੰ ਹਾਂਜੀ ਸਰ ਮੈਂ ਆਵਾਂਗੇ ਨਾ ਤੁਸੀਂ ਮਿਲੀ ਹੋ ਦੂਸਰੇ ਥੋੜ੍ਹਾ ਜਿਹਾ ਪੂਰੀ ਸਾਡੀ ਠੀਕ ਹੈ ਜੀ ਥੈਂਕ ਯੂ ਜੀ ਪੰਕਜ ਜੀ ਠੀਕ ਹੈ ਜੀ